ਨਵਜੰਮੇ ਬੱਚੇ ਦਾ ਉਸ ਦੇ ਪਹਿਲੇ ਦਿਨ ਤੋਂ ਲੈ ਕੇ ਉਹਦੇ ਇੱਕ ਸਾਲ ਹੋਣ ਤੱਕ ਉਹਦੀ ਹਾਲ ਛੋਟੀ ਮੋਟੀ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ ਉਹਦਾ ਉਹਦੀ ਬਹੁਤ ਹੀ ਜ਼ਿਆਦਾ ਕੇਅਰ ਕੀਤੀ ਜਾਂਦੀ ਹੈ ਜਦੋਂ ਬੱਚਾ ਪੰਜ ਦਿਨ ਦਾ ਹੋ ਜਾਂਦਾ ਹੈ ਤਾਂ ਉਹਨੂੰ ਪਹਿਲੀ ਵਾਰੀ ਨਹਾਇਆ ਜਾਂਦਾ ਹੈ ਪਹਿਲਾਂ ਆਪਾਂ ਉਹਨੂੰ ਜਦੋਂ ਪੰਜ ਦਿਨ ਦਾ ਹੁੰਦਾ ਉਦੋਂ ਨਹਾਉਂਦੇ ਆ ਫਿਰ ਜਦੋਂ ਉਹ ਤੇਰ੍ਹਾਂ ਦਿਨ ਦਾ ਹੋ ਜਾਂਦਾ ਉਹਨੂੰ ਆਪਾਂ ਉਦੋਂ ਨਹਾਉਂਦੇ ਫਿਰ ਜਦੋਂ ਉਹ ਇੱਕੀ ਦ ਇੱਕੀ ਇੱਕੀ ਦਿਨ ਦਾ ਹੁੰਦਾ ਏ ਫਿਰ ਜਦੋਂ ਉਹ ਇੱਕ ਮਹੀਨੇ ਦਾ ਹੋ ਜਾਂਦਾ ਇੱਦਾਂ ਵੱਖ ਵੱਖ ਦਿਨ ਉਹਨੂੰ ਨਵਾਇਆ ਜਾਂਦਾ ਹੈ ਫਿਰ ਜਦੋਂ ਬੱਚਾ ਸਵਾ ਮਹੀਨੇ ਦਾ ਹੋ ਜਾਂਦਾ ਹੈ ਫਿਰ ਘਰ ਦੇ ਵਿੱਚੋਂ ਸੂਤਕ ਖਤਮ ਹੋ ਜਾਂਦੀ ਆ ਬੱਚੇ ਨੂੰ ਕਿਤੇ ਵੀ ਬਾਹਰ ਲੈ ਕੇ ਜਾਣ ਦੀ ਇੱਕ ਫਰੀਡਮ ਇੱਕ ਆਜ਼ਾਦੀ ਮਿਲ ਜਾਂਦੀ ਆ ਆਪਾਂ ਨੂੰ ਕਿ ਜਿੱਦਾਂ ਬੱਚੇ ਛੋਟੇ ਬੱਚਿਆਂ ਨੂੰ ਨਜ਼ਰ ਬਹੁਤ ਜਲਦੀ ਲੱਗਦੀ ਹੈ ਨਾ ਅਤੇ ਫਿਰ ਜਦੋਂ ਉਹ ਸਵਾ ਮਹੀਨੇ ਦਾ ਹੋ ਜਾਂਦਾ ਫਿਰ ਉਹ ਸੂਤਕ ਜਿਹੜਾ ਉਹ ਨਜ਼ਰ ਵਾਲਾ ਉਹ ਖਤਮ ਹੋ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਉਹ ਸਵਾ ਮਹੀਨੇ ਦਾ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਉਹਦੇ ਧਾਰਮਿਕ ਅਸਥਾਨ 'ਤੇ ਮੱਥਾ ਟਿਕਾਇਆ ਜਾਂਦਾ ਏ ਉਹਨੂੰ ਗੁਰਦੁਆਰੇ ਲੈ ਕੇ ਜਾਇਆ ਜਾਂਦਾ ਹੈ ਜਾਂ ਕਈਆਂ ਦਾ ਧਾਰਮਿਕ ਅਸਥਾਨ ਉਨ ਮੰਦਰ ਹੋ ਸਕਦਾ ਏ ਉੱਥੇ ਉਹਨੂੰ ਸਭ ਤੋਂ ਪਹਿਲਾਂ ਮੱਥਾ ਟਿਕਾਇਆ ਜਾਂਦਾ ਏ ਫਿਰ ਜਦੋਂ ਉਹ ਸਵਾ ਮਹੀਨੇ ਦਾ ਹੋ ਜਾਂਦਾ ਫਿਰ ਰਿਸ਼ਤੇਦਾਰਾਂ ਦੇ ਘਰ ਉਹਨੂੰ ਆਸ਼ੀਰਵਾਦ ਪਾਉਣ ਵਾਸਤੇ ਲੈ ਕੇ ਜਾਇਆ ਜਾਂਦਾ ਏ ਵੱਖ ਵੱਖ ਰਿਸ਼ਤੇਦਾਰਾਂ ਨੂੰ ਮਿਲਾਇਆ ਜਾਂਦਾ ਹੈ ਫਿਰ ਅਗਰ ਬੱਚੇ ਬੱਚਾ ਅਗਰ ਸਰਦੀਆਂ ਵਿੱਚ ਪੈਦਾ ਹੋਇਆ ਹੋਵੇ ਅਤੇ ਉਹਦੀ ਪਹਿਲੀ ਲੋਹੜੀ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਲੋਕ ਪਹਿਲੋਂ ਸਿਰਫ ਮੁੰਡਿਆਂ ਦੀ ਲੋਹੜੀ ਮਨਾਉਂਦੇ ਸੀ ਪਰ ਅੱਜ ਕੱਲ੍ਹ ਕੁੜੀਆਂ ਦੀ ਲੋਹੜੀ ਵੀ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਏ ਕੁੜੀਆਂ ਮੁੰਡੇ ਵਿੱਚ ਕੋਈ ਫਰਕ ਨਹੀਂ ਕਰਦਾ ਅਤੇ ਜਦੋਂ ਫਾਈਨਲੀ ਬੱਚਾ ਇੱਕ ਸਾਲ ਦਾ ਹੋ ਜਾਂਦਾ ਹੈ ਅਤੇ ਉਹਦਾ ਜਦੋਂ ਪਹਿਲਾ ਬਰਡੇ ਹੁੰਦਾ ਪਹਿਲਾ ਜਨਮਦਿਨ ਹੁੰਦਾ ਏ ਉਹ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਸਾਰੇ ਆਸ ਪੜੋਸ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਮ ਬੁਲਾਇਆ ਜਾਂਦਾ ਹੈ ਵੱਡੀ ਪਾਰਟੀ ਦਿੱਤੀ ਜਾਂਦੀ ਹੈ ਇੱਦਾਂ ਵੱਖ ਵੱਖ ਰਸਮਾਂ ਹਨ ਜੋ ਆਪਾਂ ਇੱਕ ਨਵਜੰਮੇ ਬੱਚੇ ਲਈ ਕਰਦੇ ਹਨ